ਅਸੀਂ ਪੌਦਿਆਂ ਲਈ ਵੱਖ ਵੱਖ ਮੌਸਮਾਂ ਦੇ ਅਧਾਰ 'ਤੇ ਇਹ ਸਾਵਧਾਨੀਆਂ ਵਰਤਦੇ ਹਾਂ ਕਿ ਸਹੀ ਸਮੇਂ ਉਹਨਾਂ ਨੂੰ ਪਾਣੀ ਦਿੱਤਾ ਜਾਵੇ ਬਰਸਾਤੀ ਸੰਭਾਵਨਾ ਜ਼ਿਆਦਾ ਹੋਣ ਤੋਂ ਉਹਨਾਂ ਨੂੰ ਬਚਾਇਆ ਜਾਵੇ ਬਰਸਾਤ ਤੋਂ ਸਰਦੀ ਤੋਂ ਪ੍ਰੋਟੈਕਸ਼ਨ ਪ੍ਰਕਾਸ਼ ਸੰਸ਼ਲੇਸ਼ਨ ਧੁੱਪ 'ਚ ਰੱਖਣਾ ਚਾਹੀਦਾ ਹੈ ਪੌਦਾ ਪੌਦਿਆਂ ਨੂੰ ਹਮੇਸ਼ਾ ਉਪਜਾਊ ਜਮੀਨ 'ਤੇ ਲਗਾਉਣਾ ਚਾਹੀਦਾ ਹੈ ਅਤੇ ਇਹਨਾਂ ਨੂੰ ਅਨੁਕੂਲ ਵਾਤਾਵਰਨ ਵਿੱਚ ਰੱਖਣਾ ਚਾਹੀਦਾ ਹੈ ਉਹਨਾਂ ਦੀ ਸਵਾਹ ਸੰਭਾਲ ਪੂਰੀ ਤਰ੍ਹਾਂ ਕਰਨੀ ਚਾਹੀਦੀ ਹੈ ਅਤੇ ਪਾਣੀ ਅਤੇ ਧੁੱਪ ਦੀ ਮਾਤਰਾ ਵੀ ਬਰਾਬਰ ਹੋਣੀ ਚਾਹੀਦੀ ਹੈ ਮੌਸਮ ਅਨੁਸਾਰ ਬੂਟੇ ਲਗਾਉਣੇ ਚਾਹੀਦੇ ਹਨ ਜਿਹਨਾਂ ਨੂੰ ਜਲਦੀ ਫਲ ਲੱਗਦਾ ਹੈ ਉਹ ਬੂਟੇ ਬਸੰਤ ਰੁੱਤ ਵਿੱਚ ਲਗਾਏ ਜਾਂਦੇ ਹਨ ਅਤੇ ਸਾਨੂੰ ਲਗਾਉਣੇ ਚਾਹੀਦੇ ਹਨ ਸੇਬ ਅਤੇ ਡਰਾਈ ਫਰੂਟ ਦੇ ਬੂਟੇ ਸਰਦੀ ਵਿੱਚ ਹੀ ਅਨੁਕੂਲ ਰਹਿੰਦੇ ਹਨ